ਸਾਨੂੰ ਗਤਕਾ ਉਸਤਾਦ ਸਿਖਾਉਂਦਾ ਹੈ ਅਸੀਂ ਗਤਕੇ ਦੀ ਟਰੇਨਿੰਗ ਲੈਂਦੇ ਹਾਂ ਇੱਕ ਅਖਾੜਾ ਸਾਡੇ ਪਿੰਡ ਲੱਗਦਾ ਹੈ ਜਿੱਥੇ ਉਹ ਟੀਮ ਬਣਾ ਕੇ ਸਾਨੂੰ ਗਤਕੇ ਦੀ ਜੌਹਰ ਦਿਖਾਏ ਜਾਂਦੇ ਦੋ ਟੀਮਾਂ ਬਣਾਈਆਂ ਜਾਂਦੀਆਂ ਹਨ ਅਤੇ ਦੋਹਾਂ ਨੂੰ ਮੁੜ ਕੇ ਖਿਡਾਇਆ ਜਾਂਦਾ ਹੈ ਇੱਕ ਉਸਤਾਦ ਹੁੰਦਾ ਬਾਕੀ ਸਾਰੇ ਵਿਦਿਆਰਥੀ ਸਿੱਖਣ ਵਾਲੇ ਹੁੰਦੇ ਹਨ ਜੋ ਗਤਕਾ ਸ਼ਾਮ ਨੂੰ ਅਖਾੜੇ ਵਿੱਚ ਆ ਕੇ ਸਿੱਖਦੇ ਹਨ ਅਤੇ ਉਹ ਸਿਖਾਇਆ ਜਾਂਦਾ ਹੈ ਬਾਅਦ 'ਚ ਉਨ੍ਹਾਂ ਨੂੰ ਖਿਡਾ ਕੇ ਅਤੇ ਉਨ੍ਹਾਂ ਦੇ ਗਤਕੇ ਜੌਹਰ ਵਿਖਾਏ ਜਾਂਦੇ ਹਨ ਜੋ ਜਿੱਤ ਜਾਂਦਾ ਹੈ ਉਹਨੂੰ ਇਨਾਮ ਵੀ ਦਿੱਤੇ ਜਾਂਦੇ ਹਨ